ਮੈਂ ਮੈਨੂੰ ਫੁੱਲ ਫਲ ਅਤੇ ਸਬਜ਼ੀਆਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਮੈਂ ਘਰ ਵਿੱਚ ਫੁੱਲ ਫਲ ਅਤੇ ਸਬਜ਼ੀਆਂ ਅਤੇ ਤਿੰਨਾਂ ਤਰ੍ਹਾਂ ਦੀਆਂ ਚੀਜ਼ਾਂ ਉਗਾਉਣਾ ਚਾਹੁੰਦਾ ਹਾਂ ਚਾਹਵਾਂਗਾ ਕਿਉਂਕਿ ਇਹ ਫੁੱਲਾਂ ਫੁੱਲਾਂ ਦਾ ਅਲੱਗ ਅਲੱਗ ਤਰ੍ਹਾਂ ਦੇ ਅਗਰ ਗਮਲਿਆਂ ਵਿੱਚ ਫੁੱਲ ਲੱਗੇ ਹੋਣ ਤਾਂ ਮਨ ਨੂੰ ਕਿੰਨੇ ਸੋਹਣੇ ਲੱਗਦੇ ਹਨ ਮਨ ਖਿਲਿਆ ਖਿਲਿਆ ਰਹਿੰਦਾ ਹੈ ਮਨ ਪ੍ਰਸੰਨ ਰਹਿੰਦਾ ਹੈ ਪ੍ਰਸੰਨ ਵਿਅਕਤੀ ਸਾਰੇ ਕੰਮ ਹਰ ਕੋਈ ਕੰਮ ਕਰ ਸਕਦਾ ਹੈ ਆਪਣੀ ਸਿਹਤ ਨੂੰ ਵੀ ਠੀਕ ਰੱਖ ਸਕਦਾ ਫਲ ਫਲ ਖਾਣ ਨਾਲ ਵੀ ਤੁਹਾਨੂੰ ਪਤਾ ਵੈ ਹਰ ਕਿਸੇ ਨੂੰ ਸਿਹਤ ਠੀਕ ਰਹਿੰਦੀ ਹੈ ਸਿਹਤ ਠੀਕ ਰਹੇਗੀ ਉਹ ਹਰ ਤਰ੍ਹਾਂ ਦਾ ਕੰਮ ਆਰਾਮ ਨਾਲ ਕਰ ਸਕਦਾ ਹੈ ਕਿਉਂਕਿ ਇਸ ਇਸ ਹੈਲਥ ਇਜ ਅਬਵ ਵੈਲਥ ਸਿਹਤ ਅਨ ਅਮੁੱਲਿਆ ਧਨ ਹੈ ਇਹ ਅਤੇ ਉਹ ਦੂ ਦੂਜਾ ਧਨ ਨਸ਼ਟ ਹੋ ਸਕਦਾ ਅਗਰ ਸਿਹਤ ਠੀਕ ਹੋਵੇ ਅਤੇ ਤੁਹਾਡੀ ਸਿਹਤ ਤੁਹਾਡੇ ਕੋਲ ਹੀ ਰਹਿਣੀ ਹੈ ਅਤੇ ਸਬਜ਼ੀਆਂ ਸਬਜ਼ੀਆਂ ਵੀ ਅਗਰ ਅਗਰ ਘਰਾਂ ਵਿੱਚ ਅਗਰ ਉਗਾਵਾਂਗੇ ਤਾਂ ਬਜ਼ਾਰ ਨਾਲੋਂ ਸਾਨੂੰ ਇੱਕ ਸਸਤੀਆਂ ਪੈਣੀਆਂ ਇੱਕ ਔਰਗੈਨਿਕ ਪੈਣੀਆਂ ਇੱਕ ਤਾਜ਼ੀ ਮਿਲਣੀ ਹੈ ਅਤੇ ਜਿਸ ਵੇਲੇ ਚਾਹੀਏ ਉਹ ਅਵੇਲੇਬਲ ਹੈ ਜਿਸ ਤਰ੍ਹਾਂ ਹੁਣੇ ਲੋੜ ਪਵੇ ਹੁਣੇ ਸਬਜ਼ੀ ਲੋੜ ਬਣਾਉਣੀ ਤਾਂ ਹੁਣੇ ਸਬਜ਼ੀ ਤੋੜੀ ਅਤੇ ਉਹਨੂੰ ਬਣਾਉਣਾ ਸ਼ੁਰੂ ਕਰ ਦਿੰਦੇ ਘਰ ਵਿੱਚ ਇਸ ਵਿੱਚ ਫਲ ਫੁੱਲ ਅਤੇ ਸਬਜ਼ੀਆਂ ਉਗਾਉਣ ਦਾ ਘਰ ਵਿੱਚ ਤਾਂ ਬਹੁਤ ਹੀ ਫਾਇਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਉੱਥੇ ਵੀ ਅਗਰ ਇਹੋ ਜਿਹੀ ਚੀਜ਼ਾਂ ਹੋਣ ਇਹ ਫੁੱਲਾਂ ਦੇ ਉੱਤੇ ਤਿੱਤਲੀਆਂ ਵੀ ਆਉਂਦੀਆਂ ਪਸ਼ੂ ਪ ਪਕਸ਼ੀ ਵੀ ਚਹਿ ਚਹਾਉਂਦੇ ਹਨ ਅਤੇ ਇਸ ਘਰ ਵਿੱਚ ਵਾਤਾਵਰਨ ਕਿੰਨਾਂ ਸਵੱਛ ਲੱਗਦਾ ਹੈ ਅਤੇ ਬੜਾ ਸੋਹਣਾ ਲੱਗਦਾ ਹੈ ਅਤੇ ਇਸ ਵਿੱਚ ਹਰ ਕਿਸੇ ਬੰਦੇ ਨੂੰ ਵੀ ਚਾਹੀਦਾ ਕਿ ਆਪਣੇ ਘਰ ਵਿੱਚ ਫੁੱਲ ਫਲ ਅਤੇ ਸਬਜ਼ੀਆਂ ਲਗਾਵੇ ਮਿਹਰਬਾਨੀ